ਫੋਟੋਗ੍ਰਾਫੀ ਜੋ ਕਿ ਮੇਰੀ ਹੋਬੀ ਆ ਇਸ ਕਰਕੇ ਜਿਹੜੇ ਵੀ ਬਾਕੀ ਸਾਰੇ ਮੇਰੇ ਫਰੈਂਡਸ ਹੈਗੇ ਆ ਉਹ ਮੇਰੇ ਤੋਂ ਫੋਟੋਜ਼ ਖਿਚਵਾਉਣਾ ਵਧੀਆ ਸਮਝਦੇ ਆ ਕਿਉਂਕਿ ਉਹਨਾਂ ਨੂੰ ਮੇਰੀ ਫੋਟੋਗ੍ਰਾਫੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਉਹਨਾਂ ਦੇ ਫੋਨ ਵਿੱਚ ਫੋਟੋ ਵਧੀਆ ਆਉਂਦੀ ਹੈ ਕਲੈਰ ਕਲੀਅਰ ਵੀ ਆਉਂਦੀ ਆ ਬਟ ਫਿਰ ਵੀ ਉਹਨਾਂ ਨੂੰ ਮੇਰੀ ਫੋਟੋ ਖਿੱਚੀ ਹੋਈ ਜ਼ਿਆਦਾ ਪਸੰਦ ਆਉਂਦੀ ਹੈ ਉਹ ਆਪਣੇ ਫੋਨ ਵਿੱਚ ਖਿਚਵਾ ਲੈਂਦੇ ਬਟ ਉਹਨਾਂ ਨੂੰ ਖਿਚਵਾਉਣ ਲਈ ਕੋਈ ਹੋਰ ਬੰਦਾ ਨਹੀਂ ਚਾਹੀਦਾ ਉਹਨਾਂ ਨੂੰ ਮੇਰੀ ਹੀ ਫੋਟੋ ਖਿੱਚੀ ਹੋਈ ਵਧੀਆ ਲੱਗਦੀ ਹੈ ਇ ਇਸ ਕਰਕੇ ਮੇਰੇ ਕੋਲ ਮੇਰਾ ਆਪਣਾ ਕੈਮਰਾ ਵੀ ਹੈਗਾ ਹੈ ਜਿਹਦੇ ਵਿੱਚ ਮੈਂ ਆਪਣੇ ਨੇਚਰ ਦੀਆਂ ਫੋਟੋਜ਼ ਕਲਿੱਕ ਕਰਦੀ ਰਹਿੰਦੀ ਹਾਂ ਫਰੀ ਟਾਈਮ ਹੋਵੇ ਤਾਂ ਮੈਂ ਟਾਈਮਪਾਸ ਕਰਨ ਨੂੰ ਇੱਕ ਕਹਿ ਸਕ ਕਹਿ ਲਉ ਕਿ ਮਤਲਬ ਕਿ ਨੇਚਰ ਦੀਆਂ ਫੋਟੋਜ਼ ਆਪਣੇ ਡੋਗੀ ਦੇ ਪਿਕਸ ਕਲਿੱਕ ਕਰਦੀ ਰਹਿੰਦੀ ਹਾਂ ਜਿਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਕਿ ਮੈਂ ਉਹਨਾਂ ਦੀਆਂ ਫੋਟੋਜ਼ ਕਲਿੱਕ ਕਰਕੇ ਬਾਅਦ ਵਿੱਚ ਮੈਂ ਆਪਣੇ ਕੰਪਿਊਟਰ ਵਿੱਚ ਆਪਣੇ ਜਿਹੜੇ ਆ ਕੈਮਰੇ ਦੀ ਪੈ ਕੈਮਰੇ ਦਾ ਪੈਨ ਡਰਾਈਵ ਜਾਂ ਉਹਦੇ ਵਿੱਚ ਕੰਪਿਊਟਰ ਵਿੱਚ ਪਾ ਕੇ ਬਹੁਤ ਵਧੀਆ ਨਾ ਫਿਰ ਦੇਖਦੀ ਹਾਂ ਅਤੇ ਬਾਅਦ ਵਿੱਚ ਆਪਣੇ ਮੰਮਾ ਜਾਂ ਆਪਣੀ ਫੈਮਿਲੀ ਨੂੰ ਦਿਖਾਉਂਦੀ ਹਾਂ ਅਤੇ ਉਹਨਾਂ ਨੂੰ ਮੇਰੇ ਫੋਟੋਗ੍ਰਾਫੀ ਬਹੁਤ ਹੀ ਵਧੀਆ ਲੱਗਦੀ ਆ ਇਹ ਸਭ ਕੁਝ ਜਿਵੇਂ ਕਿ ਸਾਰਿਆਂ ਨੂੰ ਮੇਰੀ ਮਤਲਬ ਕਿ ਕਹਿ ਲਉ ਕਿ ਸਾਰਿਆਂ ਨੂੰ ਮੇਰੀ ਫੋਟੋਗ੍ਰਾਫੀ ਬਹੁਤ ਹੀ ਵਧੀਆ ਲੱਗਦੀ ਆ